ਸਾਡੇ ਖੇਤਰ ਦੇ ਵਿੱਚ ਜਿਹੜਾ ਕਿ ਕਲਾਬਾਜ਼ੀ ਅਤੇ ਸੱਭਿਆਚਾਰਕ ਦਾ ਵਿਕਾਸ ਹੈ ਉਹ ਸਰਕਾਰਾਂ ਵੀ ਕਰ ਰਹੀਆਂ ਨੇ ਅਤੇ ਕੌਪਰੇਟ ਘਰਾਣੇ ਵੀ ਜੇ ਗੱਲ ਕਰੀਏ ਸਰਕਾਰਾਂ ਦੀ ਤਾਂ ਉਹ ਖੇਡਾਂ ਵੱਲ ਕਾਫੀ ਧਿਆਨ ਦੇ ਰਹੀਆਂ ਨੇ ਜਿਵੇਂ ਕਿ ਪਿਛਲੇ ਸਾਲਾਂ ਦੀ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਬੱਡੀ ਲੀਗ ਕਬੱਡੀ ਜਿਹੜੀਆਂ ਸੀਗੀਆਂ ਕਬੱਡੀ ਵਰਗੀਆਂ ਗੇਮਾਂ ਜਿਨ੍ਹਾਂ ਨੂੰ ਕਿ ਅੰਤਰਰਾਸ਼ਟਰੀ ਖੇਡਾਂ ਬਹੁਤ ਉੱਪਰ ਲੈਵਲ ਤੱਕ ਪਹੁੰਚਾ ਤਾ ਸੀਗਾ ਕਬੱਡੀ ਦੇ ਕੱਪ ਵਰਲਡ ਕੱਪ ਟੂਰਨਾਮੈਂਟ ਕਰਵਾਏ ਗਏ ਸੀ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਕਰਵਾਏ ਗਏ ਸੀ ਚੰਗੇ ਨਾਮ ਸੀ ਉਹਨਾਂ ਦੇ ਵਿੱਚ ਉਹ ਇੱਕ ਸੱਭਿਆਚਾਰਕ ਖੇਡ ਆ ਸਾਡੀ ਜਿਹਨੂੰ ਕਿ ਬਹੁਤ ਉੱਪਰ ਤੱਕਰ ਪਹੁੰਚਾਇਆ ਸੀ ਸਰਕਾਰਾਂ ਨੇ ਕਾਫੀ ਇਨਾਮ ਵੀ ਵੰਡੇ ਸੀਗੇ ਅਤੇ ਜਿਸ ਦੇ ਵਿੱਚ ਵੀ ਹੋਰ ਵੀ ਲੜਕਿਆਂ ਦੇ ਵਿੱਚ ਜਿਹੜੇ ਕਾਫੀ ਨੌਜਵਾਨ ਸੀ ਉਹਨਾਂ ਚ ਕੱਡੀ ਕਬੱਡੀ ਦਾ ਕਰੇਜ਼ ਕਾਫੀ ਆ ਚੁੱਕਿਆ ਸੀ ਇਸ ਤਰ੍ਹਾਂ ਜੇ ਗੱਲ ਕਰੀਏ ਸਰਕਾਰ ਦੀ ਤਾਂ ਉਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਕਿ ਲੁਧਿਆਣੇ ਤੋਂ ਸ਼ੁਰੂ ਕੀਤੀਆਂ ਸੀਗੀਆਂ ਅਤੇ ਅਲੱਗ ਅਲੱਗ ਸ਼ਹਿਰਾਂ ਵਿੱਚ ਹੁੰਦੇ ਹੋਏ ਅਲੱਗ ਅਲੱਗ ਗੇਮਾਂ ਨੂੰ ਤਰਜੀਹ ਦਿੱਤੀ ਸੀ ਉਹਨਾਂ ਦੇ ਵਿੱਚ ਅਤੇ ਪਿੰਡਾਂ ਤੋਂ ਵੀ ਜਿਹੜੀਆਂ ਸੀਗੀਆਂ ਟੀਮਾਂ ਵੀ ਨੈਸ਼ਨਲ ਕਬੱਡੀ ਦੀਆਂ ਜਾਂਦੀਆਂ ਸੀ ਉਹਨਾਂ ਨੂੰ ਵੀ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਿਹੜੀ ਉਹਨਾਂ ਦੀ ਗੇਮਾਂ ਹੁੰਦੀਆਂ ਸੀ ਅਤੇ ਚੰਗੇ ਨਾਮ ਸੀਗੇ ਉਹ ਨਾਲ ਜਿਹੜੀਆਂ ਸੱਭਿਆਚਾਰ ਖੇਡਾਂ ਆ ਗਈਆਂ ਸਾਡੀਆਂ ਉਹਨਾਂ ਨੂੰ ਤਰਜੀਹ ਸਾਡੀ ਸਰਕਾਰ ਨੇ ਕਾਫੀ ਦਿੱਤੀ ਸੀ ਅਤੇ ਕਾਫੀ ਉਹਨੂੰ ਪ੍ਰਫੁਲਿਤ ਕੀਤਾ ਸੀਗਾ ਅਤੇ ਸਹਾਇਤਾ ਵੀ ਦਿੱਤੀ ਹੈ ਨਾ ਅਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਕੌਪਰੇਟ ਘਰਾਣੇ ਵੀ ਗੇਮਾਂ ਨੂੰ ਖੇਡਾਂ ਨੂੰ ਕਾਫੀ ਤਰਜੀਹ ਦਿੰਦੇ ਨੇਗੇ ਜਿਵੇਂ ਕਿ ਐਕਟਰ ਫਿਲਮੀ ਐਕਟਰ ਆ ਗਏ ਹੈ ਨਾ ਉਹਨਾਂ ਨੇ ਆਪਣੀਆਂ ਆਪਣੀਆਂ ਅਲੱਗ ਅਲੱਗ ਟੀਮਾਂ ਬਣਾਈਆਂ ਹੁੰਦੀਆਂ ਕ੍ਰਿਕੇਟ ਦੇ ਵਿੱਚ ਠੀਕ ਆ ਨਾ ਕ੍ਰਿਕੇਟ ਦੇ ਵਿੱਚ ਜਿਵੇਂ ਕਿ ਮੁੰਬਈ ਟੀਮ ਆ ਗਈ ਪੰਜਾਬ ਦੀ ਟੀਮ ਆ ਗਈ ਕਲਕੱਤਾ ਟੀਮ ਆ ਗਈ ਇਸ ਤਰ੍ਹਾਂ ਤਰ੍ਹਾਂ ਉਹ ਵੱਡੇ ਵੱਡੇ ਘਰਾਣੇ ਨੇ ਉਹਨਾਂ ਨੂੰ ਆਹ ਸਪੋਰਟ ਕਰ ਰਹੇ ਨੇ ਸੈਂਟਰ ਦੀਆਂ ਸਰਕਾਰਾਂ ਠੀਕ ਆ ਨਾ ਇਸ ਤਰ੍ਹਾਂ ਵੀ ਇਹ ਸਰਕਾਰਾਂ ਵੀ ਸਾਡੀ ਸਹਾਇਤਾ ਕਰ ਰਹੀਆਂ ਨੇ ਸੱਭਿਆਚਾਰਕ ਉਸ ਦੇ ਵਿੱਚ ਗੇਮਾਂ ਦੇ ਵਿੱਚ ਖੇਡਾਂ ਦੇ ਵਿੱਚ ਖੇਤਰ ਕਲਾ ਦੇ ਵਿੱਚ ਅਤੇ ਜਿਹੜਾ ਕਿ ਵੀ ਨਾਲ ਵੱਡੇ ਘਰਾਣੇ ਵੀ ਕਰ ਰਹੇ ਨੇ ਜਿਵੇਂ ਜੀਓ ਵਰਗੇ ਵੱਡੇ ਘਰਾਣੇ ਆ ਗਏ ਅਬਾਨੀ ਅਡਾਨੀ ਵਰਗੇ ਆ ਗਏ ਉਹ ਵੀ ਖੇਡਾਂ ਨੂੰ ਆਪਦੇ ਵੱਲੋਂ ਕਾਫੀ ਤਰਜੀਹ ਜਿਹੜਾ ਕਿ ਦੇ ਰਹੇ ਨੇ ਗੇ ਅਤੇ ਇਸ ਤਰ੍ਹਾਂ ਹੀ ਸਾਡੇ ਖੇਤਰ ਦੀ ਜਿਹੜੀ ਕਲਾਬਾਜ਼ੀ ਹੈ ਸੱਭਿਆਚਾਰ ਵਿਕਾਸ ਹੈ ਉਹਨੂੰ ਸਰਕਾਰਾਂ ਵੀ ਸਪੋਰਟ ਕਰ ਰਹੀਆਂ ਨੇ ਅਤੇ ਵੱਡੇ ਵੱਡੇ ਘਰਾਣੇ ਵੀ ਉਸ ਨੂੰ ਸਪੋਰਟ ਕਰਕੇ ਬਹੁਤ ਕਾਫੀ ਉੱਪਰ ਤੱਕ ਲਿਜਾ ਰਹੇ ਨੇ